ਸਤਿ ਸ਼੍ਰੀ ਅਕਾਲ ਮੈਮ ਤੁਸੀਂ ਹਾਂਜੀ ਮੈਮ ਮੀਡੀਆ ਰਿਪੋਰਟਰ ਤੋਂ ਬੋਲਦੀ ਹਾਂ ਨਿਊਜ਼ ਏਟੀਨ ਤੋਂ ਹਾਂਜੀ ਤੁਸੀਂ ਸੰਚਾਈ ਵਿਭਾਗ ਤੋਂ ਬੋਲ ਰਹੇ ਹੋ ਹਾਂਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹਵਾਂਗੀ ਮਤਲਬ ਮੈਂ ਇੱਕ ਆਰਟੀਕਲ ਲਿਖ ਰਹੀ ਹਾਂ ਜਿਹੜਾ ਕਿ ਮੈਂ ਅਖ਼ਬਾਰ 'ਚ ਦੇਣਾ ਹੈ ਅਤੇ ਪਿਛਲੇ ਸਾਲ ਤਾਂ ਇੰਨਾ ਮੀਂਹ ਵੀ ਨਹੀਂ ਪਿਆ ਤਾਂ ਫਿਰ ਆਪਣੇ ਪੰਜਾਬ 'ਚ ਹੜ੍ਹ ਵਗੈਰਾ ਕਿੱਦਾਂ ਆ ਗਏ ਤੁਸੀਂ ਕੁਛ ਦੱਸ ਸਕਦੇ ਹੋ ਮੈਨੂੰ ਤਾਂ ਇਹਦਾ ਹੋਰ ਕੋਈ ਹੱਲ ਹੈ ਨਹੀਂ ਸੀ ਮਤਲਬ ਇਹਦੇ ਕਰਕੇ ਇੰਨਾ ਨੁਕਸਾਨ ਹੋਇਆ ਪੰਜਾਬ 'ਚ ਤੁਸੀਂ ਕੋਈ ਹੋਰ ਹੱਲ ਨਹੀਂ ਕੱਢ ਸਕਦੇ ਸੀ ਇਹਦਾ ਹਾਂਜੀ ਉਹ ਤਾਂ ਹੈ ਪਰ ਤੁਸੀਂ ਸਾਨੂੰ ਕੁਛ ਇੱਦਾਂ ਦੇ ਤਰੀਕੇ ਦੱਸ ਸਕਦੇ ਹੋ ਵੀ ਜਿਹਦੇ ਨਾਲ ਇਹ ਨੁਕਸਾਨ ਨਾ ਹੋਵੇ ਜਾਂ ਅਸੀਂ ਮਤਲਬ ਕਿ ਜਿਹੜੇ ਖੇਤੀ ਕਰਦੇ ਲੋਕ ਕਿਸਾਨਾਂ ਨੂੰ ਕੁਛ ਉਵੇਂ ਦੇ ਦੱਸ ਸਕੀਏ ਨੁਸਖੇ ਕਿ ਜਿਹਨਾਂ ਕਰਕੇ ਉਹ ਹੜ੍ਹ ਤੋਂ ਬਚੇ ਰਹਿਣ ਜਿਹੜੀਆਂ ਫ਼ਸਲਾਂ ਉਹਨਾਂ ਦੀ ਖ਼ਰਾਬ ਹੋਈਆਂ ਉਹ ਨਾ ਹੋਣ ਹਾਂਜੀ ਹੋਰ ਕੁਛ ਨੁਸਖੇ ਹਾਂਜੀ ਮੈਡਮ ਫਿਰ ਇਹ ਸਾਰਾ ਅਸੀਂ ਉਹ ਅਖ਼ਬਾਰ 'ਚ ਜਿਹੜਾ ਆਰਟੀਕਲ ਹੈ ਉਹਦੇ 'ਚ ਲਿਖ ਸਕਦੇ ਹਾਂ ਹੈ ਨਾ ਅਤੇ ਜਿਹੜਾ ਪਿਛਲੇ ਸਾਲ ਨੁਕਸਾਨ ਹੋਇਆ ਸੀ ਉਹਦੇ ਬਾਰੇ ਅਸੀਂ ਇਹ ਗੱਲਾਂ ਲਿਖ ਸਕਦੇ ਵੀ ਤੁਹਾਨੂੰ ਮਜ਼ਬੂਰਨ ਇਹ ਬੰਨ ਖੋਲ੍ਹਣਾ ਪਿਆ ਜਿਹਦੇ ਕਰਕੇ ਇਹਨਾਂ ਨੂੰ ਨੁਕਸਾਨ ਹੋਇਆ ਹਾਂਜੀ

ਹਾਂਜੀ ਅਤੇ ਹੋਰ ਆਪਾਂ ਕੀ ਦੇ ਸਕਦੇ ਹਾਂ ਮਤਲਬ ਕਿ ਜੇਕਰ ਉਹ ਬੰਨ ਨਾ ਖੋਲ੍ਹਦੇ ਤਾਂ ਉਧਰ ਪਹਾੜੀ ਇਲਾਕਾ ਅਤੇ ਕਿੱਦਾਂ ਦੀ ਉਹ ਆ ਸਕਦੀ ਸੀ ਪ੍ਰੋਬਲਮ ਆ ਸਕਦੀ ਸੀ ਜਾਂ ਪਰੇਸ਼ਾਨੀ ਕਹਿ ਸਕਦੇ ਹਾਂ ਆਪਾਂ ਅੱਛਾ ਅਤੇ ਮਤਲਬ ਜਿਨ੍ਹਾਂ ਦਾ ਨੁਕਸਾਨ ਹੋਇਆ ਸੀਗਾ ਉਹਨਾਂ ਕਿਸਾਨਾਂ ਨੂੰ ਕੁਛ ਮਤਲਬ ਕਿ ਦਿੱਤਾ ਗਿਆ ਸੀਗਾ ਵੀ ਜਿਨਾਂ ਕਰਕੇ ਉਹਨਾਂ ਨੂੰ ਨੁਕਸਾਨ ਦੀ ਭਰਪਾਈ ਜ਼ਿਆਦਾ ਨਾ ਕਰਨੀ ਪਵੇ ਅੱਛਾ ਠੀਕ ਹੈ ਮੈਡਮ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਇਹ ਸਾਰਾ ਜੋ ਵੀ ਤੁਸੀਂ ਦੱਸਿਆ ਮੈਨੂੰ ਇਹ ਸਾਰਾ ਮੈਂ ਆਪਣੇ ਆਰਟੀਕਲ 'ਤੇ ਲਿਖਾਂਗੀ ਤਾਂ ਕਿ ਜਿਹੜੇ ਲੋਕ ਆ ਹੋਰ ਜਾਗਰੂਕ ਹੋਣ ਅਤੇ ਇਹਨਾਂ ਸਮੱਸਿਆ ਤੋਂ ਬਚਦੇ ਰਹਿਣ ਠੀਕ ਹੈ ਮੈਮ ਸਤਿ ਸ਼੍ਰੀ ਅਕਾਲ